ਇੱਕ ਜਨਵਰੀ ਦੋ ਹਜ਼ਾਰ ਇੱਕ ਚਾਰ ਸਪਟੰਬਰ ਉੱਨੀ ਸੌ ਤ੍ਰਿਆਨਵੇਂ ਪੰਜ ਜੁਲਾਈ ਉੱਨੀ ਸੌ ਬਾਨਵੇਂ ਗਿਆਰ੍ਹਾਂ ਜੁਲਾਈ ਉੱਨੀ ਸੌ ਚੁਹੱਤਰ ਉੱਨੀ ਅਕਟੂਬਰ ਦੋ ਹਜ਼ਾਰ ਇੱਕ